ਮੈਂ ਅਕਸਰ ਕੈਬ ਬੁੱਕ ਕਰਦਾ ਰਹਿੰਦਾ ਹਾਂ ਕਿਉਂਕਿ ਕਦੋਂ ਵੀ ਮੇਰੇ ਕੋਲ ਗੱਡੀ ਨਹੀਂ ਹੁੰਦੀ ਤਾਂ ਮੈਂ ਉਸ ਉਸ ਟੈਮ ਕੈਬ ਨਾਲ ਟਰੈਵਲ ਕਰਨਾ ਪਸੰਦ ਕਰਦਾ ਹੈ ਕਿਉਂਕਿ ਉਹ ਸਸਤੀ ਵੀ ਹੁੰਦੀ ਆ ਅਤੇ ਉਹਦੇ ਵਿੱਚ ਆਪਾਂ ਨੂੰ ਗੱਡੀ ਚਲਾਉਣ ਦੀ ਲੋੜ ਨਹੀਂ ਪੈਂਦੀ ਪਿਛਲੇ ਹਫ਼ਤੇ ਮੈਂ ਇੱਕ ਕੈਬ ਬੁੱਕ ਕੀਤੀ ਸੀਗੀ ਕ ਗ ਟੈਕਸੀ ਕੰਪਨੀ ਤੋਂ ਅਤੇ ਉਹ 'ਤੇ ਸਾਨੂੰ ਪਹਿਲਾਂ ਪਤਾ ਲੱਗਿਆ ਕਿ ਟੈਕਸੀ ਕੰਪਨੀ ਸਰਵਿਸ ਕਿਹੜੀ ਹੁੰਦੀ ਵਧੀਆ ਨਹੀਂ ਹੈਗੀ ਅਤੇ ਉਸ ਤੋਂ ਬਾਅਦ 'ਚੋਂ ਪਰ ਮੈਂ ਮੈਨੂੰ ਕਾਹਲੀ ਸੀਗੀ ਅਤੇ ਉਹ ਉੱਥੇ ਹੋਰ ਕੋਈ ਕੈਬ ਵੀ ਇੱਕ ਹੈ ਨਹੀਂ ਸੀਗੀ ਅਤੇ ਇਸ ਲੀਏ ਮੈਂ ਅਤੇ ਮੈਂ ਤਾਂ ਕਰਕੇ ਨਾ ਕੈਬ ਵਾਲਿਆਂ ਕੋਲ ਟੈਕਸੀ ਕੈਬ ਵਾਲਿਆਂ ਕੋਲ ਕੈਬ ਬੁੱਕ ਕਰ ਲਈ ਅਤੇ ਉਹ ਉੱਥੇ ਤੋਂ ਮੈਂ ਟਰੈਵਲ ਕੀਤਾ ਮੈਂ ਉਦੋਂ ਟਰੈਵਰ ਕੀਤਾ ਸੀਗਾ ਜਲੰਧਰ ਅਤੇ ਸਾਨੂੰ ਮੈਨੂੰ ਜਾਣ ਕੇ ਬਹੁਤ ਖੁਸ਼ੀ ਹੋਈ ਕਿਉਂਕਿ ਉਹ ਬਹੁਤ ਜ਼ਿਆਦਾ ਡਿਸਕਾਊਂਟ ਪਰ ਦਿੰਦੇ ਆ ਬੰਦੇ ਨੂੰ ਅਤੇ ਰੀਜ਼ਨੇਬਲ ਵੀ ਹੁੰਦਾ ਕਿ ਅ ਗਰੀਬ ਅਤੇ ਅਮੀਰ ਬੰਦਾ ਆਰਾਮ ਨਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾ ਸਕਦਾ ਹੈ ਅਤੇ ਉਸ ਤੋਂ ਬਾਅਦ ਟਰੈਵਲ ਕਰਨ ਤੋਂ ਬਾਅਦ 'ਚੋਂ ਮੈਂ ਬਹੁਤ ਖੁਸ਼ ਹੋਇਆ ਕਿਉਂਕਿ ਉਹਨਾਂ ਦੀ ਕਸਟਮਰ ਸਰਵਿਸ ਬਹੁਤ ਵਧੀਆ ਸੀਗੀ ਅਤੇ ਮੈਂ ਉਹਨਾਂ ਦਾ ਮੈਂ ਨੰਬਰ ਲੈ ਲਿਆ ਉਹਨਾਂ ਦੇ ਬੰਦੇ ਦਾ ਅਤੇ ਫਿਰ ਮੈਂ ਅਗਲੇ ਹਫ਼ਤੇ ਨੈਨੀਤਾਲ ਜਾਣਾ ਸੀਗਾ ਆਪਣੇ ਦੋਸਤ ਦੇ ਨਾਲ ਫਿਰ ਮੈਂ ਉਹਨਾਂ ਨੂੰ ਫ਼ੋਨ ਕੀਤਾ ਕਿ ਮੈਂ ਉੱਥੇ ਜਾਣਾ ਹੈ ਤਾਂ ਕਰਕੇ ਤੁਸੀਂ ਆਪਣੀ ਸਰਵਿਸ ਦਿਉ ਕਿਉਂਕਿ ਤੁਹਾਡੀ ਸਰਵਿਸ ਬਹੁਤ ਵਧੀਆ ਹੈ ਅਤੇ ਉਹਨਾਂ ਨੂੰ ਵੀ ਬਹੁਤ ਖੁਸ਼ ਹੋਇਆ ਅਤੇ ਉਹ ਅਕਸਰ ਆਪਣੀ ਫੀਡਬੈਕ ਲੈਂਦੇ ਰਹਿੰਦੇ ਸੀਗੇ ਲੋਕਾਂ ਦੇ ਕੋਲ ਅਤੇ ਉਹਨਾਂ ਨੂੰ ਵੀ ਬਹੁਤ ਖੁਸ਼ੀ ਹੋਈ ਕਿਉਂਕਿ ਮੈਂ ਉਹਨਾਂ ਦੀ ਗੱਡੀਆਂ ਬੁੱਕ ਕੀਤੀ ਕਿਤੇ ਮੈਨੂੰ ਡਿਸਕਾਊਂਟ ਵੀ ਜ਼ਿਆਦਾ ਵਧੀਆ ਦਿੱਤਾ ਕਿਉਂਕਿ ਮੈਂ ਉਹਨਾਂ ਦਾ ਪੱਕਾ ਕਸਟਮਰ ਬਣ ਗਿਆ ਸੀਗੇ ਅਤੇ ਇਸ ਕਰਕੇ ਜਦੋਂ ਵੀ ਮੈਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾਣਾ ਹੋਵੇ ਮੈਂ ਉਹਨਾਂ ਦੀ ਗੱਡੀ ਬੁੱਕ ਕਰਦਾ ਹਾਂ ਕਿਉਂਕਿ ਉਹ ਜ਼ਿਆਦਾ ਜ਼ਿਆਦਾ ਸਸਤੀਆਂ ਬਾਕੀ ਨਾਲੋਂ ਅਤੇ ਮੈਂ ਉਹਨਾਂ ਦਾ ਪੱਕਾ ਗਾਹਕ ਬਣ ਗਿਆ ਅਤੇ ਮੈਨੂੰ ਡਿਸਕਾਉਂਟ ਵੀ ਦਿੰਦੇ ਰਹਿੰਦੇ ਹਨ ਤਾਂ ਕਰਕੇ ਕਦੋਂ ਵੀ ਮੈਨੂੰ ਲੋੜ ਪਵੇ ਮੈਂ ਉਹਨਾਂ ਨੂੰ ਕੈਬ ਕਰਦਾ ਅਤੇ ਮੈਂ ਉਹਨਾਂ ਦਾ ਬੰਦੇ ਦਾ ਪੱਕਾ ਹੀ ਨੰਬਰ ਸੇਵ ਕੀਤਾ ਹੋਇਆ ਕਿਉਂਕਿ ਨੰਬਰ ਸੇਵ ਕਰਨ ਦੇ ਨਾਲ ਮੈਨੂੰ ਵੇਟਿੰਗ 'ਚ ਨਹੀਂ ਖੜ੍ਹਨਾ ਪੈਂਦਾ ਅਤੇ ਮੈਂ ਕਿੱਥੇ ਵੀ ਜਾਣਾ ਹੋਵੇ ਮੈਂ ਇਕਦਮ ਜਾ ਸਕਦਾ ਹੈ ਪਹਿਲਾਂ ਬਿਨਾਂ ਪਹਿਲੇ ਦੱਸੇ